ਮੇਰੀ ਜੋ ਮੂਲ ਭਾਸ਼ਾ ਉਹ ਪੰਜਾਬੀ ਮੂਲ ਭਾਸ਼ਾ ਹੈ ਅਤੇ ਮੈਂ ਆਪਣੀ ਮੂਲ ਭਾਸ਼ਾ ਦੇ ਵਿੱਚ ਵੀ ਕਾਫੀ ਬੁੱਕਸ ਪੜ੍ਹੀਆਂ ਉਹ ਤਾਂ ਪੜ੍ਹਨੀਆਂ ਨੇ ਇਸ ਤੋਂ ਇਲਾਵਾ ਮੈਂ ਹੋਰ ਭਾਸ਼ਾਵਾਂ ਦੇ ਵਿੱਚ ਜਿਹੜੀਆਂ ਹੈਗੀਆਂ ਇੰਗਲਿਸ਼ ਦੇ ਵਿੱਚ ਵੀ ਕਾਫੀ ਬੁੱਕਸ ਆਪਣੇ ਸਬਜੈਕਟ ਦੀਆਂ ਜੋਗਰਫੀ ਦੀਆਂ ਇੰਗਲਿਸ਼ ਵਾਲੀਆਂ ਇਸ ਤੋਂ ਇਲਾਵਾ ਕੁਛ ਨੋਵਲਜ਼ ਵਗੈਰਾ ਜਾਂ ਹੋਰ ਬੁੱਕਸ ਵੀ ਇੰਗਲਿਸ਼ ਦੇ ਵਿੱਚ ਪੜ੍ਹੀਆਂ ਨੇ ਜੇਕਰ ਅਨੁਵਾਦ ਦੀ ਗੱਲ ਕਰੀਏ ਤਾਂ ਮੈਂ ਅਨੁਵਾਦ ਦੇ ਵਿੱਚ ਵੀ ਕੁਛ ਬੁੱਕਸ ਪੜ੍ਹੀਆਂ ਨੇ ਜੋ ਕਿ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਹੋਈਆਂ ਪਈਆਂ ਨੇ ਅਤੇ ਅਨੁਵਾਦ ਦੇ ਰਿਗਾਡਿੰਗ ਮੇਰਾ ਇੱਕ ਦੀ ਜਿਹੜੀ ਹੈਗੀ ਕਿਤਾਬ ਉਹਨੂੰ ਛੱਡ ਕੇ ਜ਼ਿਆਦਾਤਰ ਜਿਹੜਾ ਮੇਰਾ ਐਕਸਪੀਰੀਅੰਸ ਹੈ ਉਹ ਚੰਗਾ ਹੀ ਰਿਹਾ ਹੈਗਾ ਤਾਂ ਮੇਰੇ ਖਿਆਲ ਅਨੁਸਾਰ ਜਿਹੜਾ ਹੈ ਅਨੁਵਾਦ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਹੈਗਾ ਤਾਂ ਜੋ ਉਸ ਮੂਲ ਭਾਸ਼ਾ ਦੇ ਜਿਹੜੇ ਲੋਕਾਂ ਦੇ ਜਿਹੜੇ ਵਿਚਾਰ ਨੇ ਉਹ ਬਾਕੀ ਭਾਸ਼ਾਵਾਂ ਦੇ ਲੋਕਾਂ ਤੱਕ ਵੀ ਪਹੁੰਚੇ ਅਤੇ ਤਾਂ ਜਿਹੜੀ ਭਾਸ਼ਾ ਹੈਗੀ ਆ ਇੱਕ ਬੈਰੀਅਰ ਦੇ ਰੂਪ ਦੇ ਵਿੱਚ ਨਾ ਹੋ ਕੇ ਉਹ ਜਿਹੜੇ ਵਿਚਾਰ ਨੇ ਉਹ ਟ੍ਰਾਂਸਫਰ ਇੱਕ ਤੋਂ ਥਾਂ ਦੂਜੀ ਥਾਂ 'ਤੇ ਹੋਣੇ ਚਾਹੀਦੇ ਨੇ ਅਤੇ ਜੇ ਭਾਸ਼ਾ ਦੀ ਗੱਲ ਕਰੀਏ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਕਿਤਾਬ ਤਾਂ ਮੈਂ ਸੁਜੈਸਟ ਕਰਾਂਗਾ ਵੀ ਜਿਹੜੀ ਸੁੰਦਰੀ ਨਾਵਲ ਹੈ ਭਾਈ ਵੀਰ ਸਿੰਘ ਜੀ ਦਾ ਜਾਂ ਰਾਣਾ ਬਭੋਰ ਹਨ ਹੈ ਕਿਤਾਬ ਭਾਈ ਵੀਰ ਸਿੰਘ ਜੀ ਦੀ ਉਹ ਸਾਰੇ ਜਿਹੜੀ ਹੈਗੀ ਆ ਹੋਰ ਭਾਸ਼ਾਵਾਂ ਵਿੱਚ ਵੀ ਟ੍ਰਾਂਸਲੇਟ ਹੋ ਕੇ ਜਿਹੜੀ ਹੈਗੀ ਆ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ ਤਾਂ ਜੋ ਉਸ ਚੀਜ਼ ਨੂੰ ਉਹ ਵੀ ਪੜ੍ਹ ਸਕਣ